ਅੱਜ ਕੱਲ੍ਹ ਦੇ ਫੈਸ਼ਨ ਬਾਰੇ ਮੈਂ ਕੀ ਬੋਲਾਂ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਬਹੁਤ ਹੀ ਸਿੰਪਲ ਅਤੇ ਸਾਦਾ ਹੈ ਪਰੰਤੂ ਅੱਜ ਕੱਲ੍ਹ ਜਿਹੜਾ ਫੈਸ਼ਨ ਹੈ ਉਹ ਪੱਛਮੀ ਸੱਭਿਆਚਾਰ ਦਾ ਫੈਸ਼ਨ ਹੈ ਜਿਹੜਾ ਉਹ ਪੰਜਾਬੀ ਭਾਰਤੀ ਲੋਕਾਂ ਨੇ ਅਪਣਾ ਲਿਆ ਹੈ ਅੱਜ ਕੱਲ੍ਹ ਦੇ ਜਿਹੜੇ ਕੱਪੜੇ ਹੈ ਉਹ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਬਦਲ ਗਏ ਹੈ ਪੱਛਮੀ ਸੱਭਿਆਚਾਰ ਦੇ ਜੋ ਵੀ ਲੋਕ ਭਾਰਤ ਦੇ ਵਿੱਚ ਆਉਂਦੇ ਹੈ ਲੋਕ ਉਹਨਾਂ ਨੂੰ ਦੇਖ ਕੇ ਬੜਾ ਛੇਤੀ ਪ੍ਰਭਾਵਿਤ ਹੋ ਜਾਂਦੇ ਹੈ ਇਹ ਭਾਰਤੀ ਲੋਕਾਂ ਦੇ ਵਿੱਚ ਇੱਕ ਅਵਗੁਣ ਹੀ ਕਹਿ ਲਈਏ ਇਹ ਹੈ ਕਿ ਉਹ ਦੂਸਰਿਆਂ ਦੇ ਪ੍ਰਭਾਵ ਦੇ ਵਿੱਚ ਬਹੁਤ ਛੇਤੀ ਆ ਜਾਂਦੇ ਹੈ ਅਤੇ ਆਪਣੇ ਸੱਭਿਆਚਾਰ ਨੂੰ ਉਹ ਪਿੱਛੇ ਸਮਝਦੇ ਹੈ ਉਹਨਾਂ ਤੋਂ ਮੈਂ ਭਾਰਤੀ ਸੱਭਿਆਚਾਰ ਅਤੇ ਭਾਰਤੀ ਕੱਪੜੇ ਜੋ ਸਾਡਾ ਕਲਚਰ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਉਹਨਾਂ ਨੂੰ ਪਹਿਨਣਾ ਪਸੰਦ ਕਰਦੀ ਹਾਂ ਅਤੇ ਅਤੇ ਮੈਂ ਚਾਹੁੰਦੀ ਹਾਂ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਵਧੀਆ ਸਮਝੀਏ ਅਤੇ ਮੈਂ ਪੰਜਾਬੀ ਸੂਟ ਪਟਿਆਲਾ ਸ਼ਾਹੀ ਸੂਟ ਫੁਲਕਾਰੀਆਂ ਵਾਲੇ ਸੂਟ ਪੰਜਾਬੀ ਜੁੱਤੀ ਇਹ ਸਭ ਕੁਝ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਇਹ ਖਰੀਦਦੀ ਹਾਂ ਮੈਂ ਆਪਣੇ ਕੱਪੜੇ ਖੰਨੇ ਤੋਂ ਸਮਰਾਲ਼ੇ ਤੋਂ ਰੋਪੜ ਤੋਂ ਇੱਦਾਂ ਦੇ ਸ਼ਹਿਰਾਂ ਤੋਂ ਖਰੀਦਦੀ ਹਾਂ ਅਤੇ ਬਾਕੀ ਚੰਡੀਗੜ੍ਹ ਤੋਂ ਵੀ ਖਰੀਦ ਲੈਂਦੀ ਹਾਂ ਅੱਜ ਕੱਲ੍ਹ ਜਿਹੜੇ ਲੋਕ ਹੈ ਉਹ ਪੰਜਾਬੀ ਲੋਕ ਪੱਛਮੀ ਸੱਭਿਆਚਾਰ ਭਾਰਤੀ ਲੋਕ ਕਹਿ ਸਕਦੇ ਹਾਂ ਅਸੀਂ ਉਹ ਸਾਰੇ ਪੱਛਮੀ ਸੱਭਿਆਚਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹੈ ਛੋਟੇ ਛੋਟੇ ਕੱਪੜੇ ਪਾਉਣੇ ਸਟਾਰਟ ਕਰ ਦਿੱਤੇ ਹੈ ਜੀਨਾਂ ਕੁ ਟੋਪ ਛੋਟੀਆਂ ਛੋਟੀਆਂ ਸਕਰਟਸ ਇੱਦਾਂ ਦੇ ਕੱਪੜੇ ਪਾਉਣੇ ਸਟਾਰਟ ਕਰ ਦਿੱਤੇ ਹੈ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਇੱਧਰ ਉੱਧਰ ਦੇ ਜੋ ਪੱਛਮੀ ਹੈ ਅਤੇ ਬਾਹਰਲੇ ਲੋਕ ਹੈ ਉਹਨਾਂ ਨੂੰ ਦੇਖਦੇ ਹੈ ਅਤੇ ਬੜੀ ਜਲਦੀ ਪ੍ਰਭਾਵਿਤ ਹੋ ਕੇ ਉੱਦਾਂ ਦੇ ਹੀ ਬਣਨ ਲੱਗ ਜਾਂਦੇ ਹੈ ਉੱਦਾਂ ਦੇ ਹੀ ਫੈਸ਼ਨ ਦੇ ਕੱਪੜੇ ਜੁੱਤੀਆਂ ਸਭ ਕੁਛ ਉੱਦਾਂ ਦਾ ਹੀ ਪਾਉਣਾ ਸਟਾਰਟ ਕਰ ਦਿੰਦੇ ਹੈ ਪਰੰਤੂ ਸਾਨੂੰ ਆਪਣੇ ਸੱਭਿਆਚਾਰ ਨੂੰ ਆਪਣੀਆਂ ਜੜਾਂ ਨੂੰ ਨਹੀਂ ਭੁੱਲਣਾ ਚਾਹੀਦਾ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਸਾਡਾ ਸੱਭਿਆਚਾਰ ਵੀ ਬਹੁਤ ਅੱਛਾ ਸੱਭਿਆਚਾਰ ਹੈ